ਹਾਂਜੀ ਸੰਦੀਪ ਵੀਰੇ ਕੀ ਹਾਲ ਆ ਗੁਰੂ ਨਾਨਕ ਟਰਾਂਸਪੋਰਟ ਤੋਂ ਬੋਲਦੇ ਜੀ ਹਾਂਜੀ ਵੀਰੇ ਮੇਰੇ ਵੀਰੇ ਨੰਬਰ ਦਿੱਤਾ ਜੀ ਤੁਹਾਡਾ ਉਹ ਜਾਣਦਾ ਹੋਣਾ ਤੁਹਾਨੂੰ ਜੀ ਵੀਰੇ ਆਪਾਂ ਨੂੰ ਇਨੋਵਾ ਗੱਡੀ ਚਾਹੀਦੀ ਸੀਗੀ ਇੱਕ ਮੈਂ ਜਾਣਾ ਸੀਗਾ ਜੀ ਨਕੋਦਰ ਪਰਿਵਾਰ ਨਾਲ ਹੀ ਇਹ ਜੀ ਆਪਣਾ ਪੈ ਜੂਗਾ ਇੱਕ ਸੌ ਦਸ ਕਿੱਲੋਮੀਟਰ ਪੈ ਜੂਗਾ ਜੀ ਆਪਾਂ ਨੂੰ ਹਾਂਜੀ ਪਰਿਵਾਰ 'ਚ ਜੀ ਆਪਾਂ ਹੋਵਾਂਗੇ ਮੈਂ ਹੋਊਗਾ ਜੀ ਭਰਾ ਹੋਊਗਾ ਮੰਮੀ ਡੈਡੀ ਹੋਣਗੇ ਚਾਚਾ ਚਾਚੀ ਹੋ ਜਾਣਗੇ ਅੱਠ ਨੌਂ ਜਾਣੇ ਹੋ ਜਾਂਗੇ ਜੀ ਹਾਂਜੀ ਹਾਂਜੀ ਹਾਂਜੀ ਕੀ ਪੈ ਜੂਗਾ ਕਿਰਾਇਆ ਜੀ ਆਪਾਂ ਨੂੰ ਕਿੰਨਾਂ ਜੀ ਪੰਜ ਹਜ਼ਾਰ ਤਾਂ ਜ਼ਿਆਦਾ ਜੀ ਸਹੀ ਸਹੀ ਕਰ ਲਓ ਜੀ ਆਪਾਂ ਅੱਗੇ ਵੀ ਫਿਰ ਅੰਮ੍ਰਿਤਸਰ ਵੀ ਜਾਣਾ ਹੀ ਆ ਅਗਲੇ ਮਹੀਨੇ ਜੀ ਫਿਰ ਅਪ ਫਿਰ ਕਰ ਲਾਂਗੇ ਆਪਾਂ ਜੀ ਹਾਂਜੀ ਚਾਰ ਹਜ਼ਾਰ ਕਰ ਲਓ ਸਹੀ ਸਹੀ ਚਾਰ ਹਜ਼ਾਰ ਠੀਕ ਹੈ ਜੀ ਚਾਰ ਹਜ਼ਾਰ ਦੇ ਵਿੱਚ ਠੀਕ ਆ ਜੀ ਚਾਰ ਹਜ਼ਾਰ ਕੋਈ ਜ਼ਿਆਦਾ ਨਹੀਂ ਹੈਗਾ ਫਿਰ ਜਾਣਾ ਹੀ ਹੈ ਜੀ ਆਪਾਂ ਨੇ ਹੁਣ ਅੰਮ੍ਰਿਤਸਰ ਜਾਣਾ ਜੀ ਫਿਰ ਉਹਦੇ ਵਿੱਚੋਂ ਕਰ ਲਾਂਗੇ ਆਪਾਂ ਜੀ ਹਾਂਜੀ ਠੀਕ ਹੈ ਜੀ ਫਿਰ ਆਪਾਂ ਪ ਜਾਵਾਂਗੇ ਜੀ ਗਿਆਰ੍ਹਾਂ ਤਰੀਕ ਨੂੰ ਜਾਵਾਂਗੇ ਮੈਨੂੰ ਨੰਬਰ ਮੈਂ ਤੁਹਾਨੂੰ ਕੋਲ ਕਰ ਦੂੰਗਾ ਤੁਸੀਂ ਫਿਰ ਕਰ ਲਿਓ ਜੀ ਹਾਂਜੀ ਅਡਵਾਂਸ ਤਾਂ ਨਹੀਂ ਚਾਹੀਦਾ ਜੀ ਠੀ ਠੀਕ ਹੈ